ਕਾਫੀ ਸਾਰੇ ਅਖ਼ਬਾਰ ਅਤੇ ਟੀ ਵੀ ਨਿਊਜ਼ ਚੈਨਲ ਮਹੱਤਵਪੂਰਨ ਨੇ ਅਤੇ ਇਹਨਾਂ ਦਾ ਕਾਫੀ ਸਾਰੇ ਅਲੱਗ ਅਲੱਗ ਤਰੀਕੇ ਦੇ ਜਿਵੇਂ ਕਿ ਅਖ਼ਬਾਰ ਆਉਂਦੇ ਨੇਗੇ ਅਖ਼ਬਾਰਾਂ ਵਿੱਚ ਆਉਂਦੇ ਨੇ ਦ ਅਜੀਤ ਅਖ਼ਬਾਰ ਆਉਂਦਾ ਦਾ ਟ੍ਰਿਬਿਊਨ ਆਉਂਦਾ ਪੰਜਾਬ ਕੇਸਰੀ ਆਉਂਦਾ ਇਹ ਅਖ਼ਬਾਰ ਸਾਰੇ ਆਪਣੀ ਆਪਣੀ ਅਲੱਗ ਅਲੱਗ ਭਾਸ਼ਾ ਦੇ ਹੁੰਦੇ ਨੇ ਅਜੀਤ ਹੈ ਅਤੇ ਜਗਬਾਣੀ ਹੈ ਪੰਜਾਬੀ ਦੇ ਅਖ਼ਬਾਰ ਨੇਗੇ ਜਿਹੜਾ ਪੰਜਾਬ ਕੇਸਰੀ ਹੈ ਉਹ ਹਿੰਦੀ ਦਾ ਅਖ਼ਬਾਰ ਹੈ ਅਤੇ ਜਿਹੜਾ ਦ ਟ੍ਰਿਬਿਊਨ ਹੈ ਉਹ ਅੰਗਰੇਜ਼ੀ ਦਾ ਅਖ਼ਬਾਰ ਹੈ ਸਾਰੇ ਲੋਕ ਆਪਣੀ ਆਪਣੀ ਭਾਸ਼ਾ ਦੇ ਅਨੁਸਾਰ ਇਹ ਅਖ਼ਬਾਰ ਪੜ੍ਹਨਾ ਪਸੰਦ ਕਰਦੇ ਨੇਗੇ ਅਤੇ ਅਸੀਂ ਸਾਡੇ ਘਰ ਅਜੀਤ ਅਖ਼ਬਾਰ ਲਗਾਇਆ ਹੋਇਆ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਅਜੀਤ ਅਖ਼ਬਾਰ ਤੋਂ ਹੀ ਅ ਖ਼ਬਰਾਂ ਪੜ੍ਹਦੇ ਨੇਗੇ ਅਤੇ ਸਾਰੇ ਲੋਕ ਅ ਉਹਨੂੰ ਦੱਸਦੇ ਨੇ ਖ਼ਬਰਾਂ ਬਾਰੇ ਸਾਡੇ ਘਰ ਵਿੱਚ ਸਭ ਤੋਂ ਵੱਧ ਟੀ ਵੀ ਨਿਊਜ਼ ਚੈਨਲ ਹੈਗਾ ਜਿਹੜਾ ਚੱਲਣ ਵਾਲਾ ਉਹ ਪੀ ਟੀ ਸੀ ਹੈ ਉਹਨਾਂ ਤੋਂ ਅਸੀਂ ਕਾਫੀ ਸਾਰੇ ਅ ਖਬ ਖ਼ਬਰਾਂ ਬਾਰੇ ਸੁਣਦੇ ਹਾਂ ਅਤੇ ਉਹਨਾਂ ਦੇ ਅਨੁਸਰਨ ਅਸੀਂ ਜਿਹੜਾ ਕਿ ਦੇਖਦੇ ਹਾਂ ਕਿਉਂਕਿ ਉਹ ਸਿੱਧਾ ਹੀ ਸਾਨੂੰ ਲਾਈਵ ਹੈ ਜਿਹੜੀ ਕਿ ਨਿਊਜ਼ ਹੈ ਉਹ ਸਾਨੂੰ ਪ੍ਰਦਾਨ ਕਰ ਦਿੰਦੇ ਨੇਗੇ ਅਤੇ ਇਹਦੇ ਨਾਲ ਕੀ ਹੈ ਸਾਨੂੰ ਸਾਰਾ ਕੁਛ ਪਤਾ ਲੱਗ ਜਾਂਦਾ ਹੈ ਕਿ ਸਾਡੀ ਦੁਨੀਆ ਦਾਰੀ ਵਿੱਚ ਕੀ ਹੋ ਰਿਹਾ ਹੈ ਅਤੇ ਸਾਨੂੰ ਗਲਤ ਕੋਈ ਵੀ ਜਾਣਕਾਰੀ ਨਹੀਂ ਪ੍ਰਦਾਨ ਕਰਦੇ ਹੈਗੇ ਇਹ ਇੱਕ ਬਹੁਤ ਹੀ ਭਰੋਸੇਯੋਗ ਹੈ ਜਿਹੜਾ ਕਿ ਇਹ ਚੈਨਲ ਹੈ ਲੋਕ ਕਾਫੀ ਸਾਰੇ ਇਸ 'ਤੇ ਵਿਸ਼ਵਾਸ਼ ਕਰਦੇ ਨੇ ਸਾਡਾ ਵੀ ਇਹ ਕਾਫੀ ਵਿਸ਼ਵਾਸ਼ ਯੋਗ ਚੈਨਲ ਬਣ ਚੁੱਕਿਆ ਹੈ ਕਿਉਂਕਿ ਇੱਕ ਤਾਂ ਇਹ ਸਰਕਾਰ ਦਾ ਚੈਨਲ ਹੈ ਅਤੇ ਇਹ ਕੀ ਇੱਕ ਕਾਫੀ ਪੁਰਾਣਾ ਚੈਨਲ ਹੈ ਅਤੇ ਉਹ ਜਿਹੜਾ ਅਜੀਤ ਅਖ਼ਬਾਰ ਹੈ ਉਹ ਵੀ ਕਾਫੀ ਵਧੀਆ ਉਹ ਉਹ ਅਸੀਂ ਸਿਰਫ਼ ਪੜ੍ਹਨ ਲਈ ਯੂਸ ਕਰਦੇ ਹੈ ਕਿਉਂਕਿ ਉਹਦੇ ਵਿੱਚ ਕਾ ਕਾਫੀ ਸਾਰੀਆਂ ਜਿਹੜੀਆਂ ਪਿਕਚਰਾਂ ਨੇ ਉਹ ਨਹੀਂ ਵੀ ਪ੍ਰਦਾਨ ਕੀਤੀਆਂ ਜਾ ਸਕਦੀਆਂ ਅਤੇ ਸਾਰਿਆਂ ਨੂੰ ਹੀ ਅਖ਼ਬਾਰ ਪੜ੍ਹਨਾ ਚਾਹੀਦਾ